ਪਿਛਲੇ ਕੁਝ ਦਹਾਕਿਆਂ ਦਾ ਯੁੱਗ ਭਾਰਤ ਵਿੱਚ ਟੈਕਨੋਲੋਜੀ ਦਾ ਯੁੱਗ ਰਿਹਾ ਮੋਬਾਇਲ ਫੋਨ ਦੇ ਆਉਣ ਦੇ ਨਾਲ ਸਾਰਿਆਂ ਦੀ ਜ਼ਿੰਦਗੀ ਬਦਲ ਗਈ ਹੈ ਹੁਣ ਆਦਮੀ ਘਰੇ ਬੈਠਾ ਬੈਠਾ ਮੋਬਾਇਲ ਦੀ ਵਰਤੋਂ ਕਰਕੇ ਬਹੁਤ ਸਾਰੇ ਪੈਸੇ ਕਮਾ ਸਕਦਾ ਹੁਣ ਤੁਹਾਨੂੰ ਧੁੱਪ ਵਿੱਚ ਸੜ ਕੇ ਮਿਹਨਤ ਕਰਨ ਦੀ ਲੋੜ ਨਹੀਂ ਹੈ ਤੁਸੀਂ ਘਰੇ ਬੈਠੇ ਬੈਠੇ ਵੀ ਲੱਖਾਂ ਦੀ ਕਮਾਈ ਕਰ ਸਕਦੇ ਹੋ ਯੂਟਿਊਬਰ ਹੋ ਗਏ ਵੀ ਜਾਂ ਕੋਮੇਡੀਅਨ ਹੋ ਗਏ ਜਾਂ ਯਾਤਰੀ ਗਾਈਡ ਹੋ ਗਏ ਜੋ ਕਿ ਤੁਹਾਨੂੰ ਆ ਤੁਸੀਂ ਜਿੱਥੇ ਜਿ ਜਿਹਨਾਂ ਥਾਵਾਂ 'ਤੇ ਨਹੀਂ ਜਾ ਸਕਦੇ ਉਹ ਥਾਵਾਂ 'ਤੇ ਉਹ ਜਾ ਕੇ ਤੁਹਾਨੂੰ ਗਾਈਡ ਕਰਦੇ ਰਹਿੰਦੇ ਹਨ ਅਤੇ ਇੱਥੋਂ ਦਾ ਇਹ ਮੌਸਮ ਹੈ ਇੱਥੋਂ ਦੀ ਇਹ ਅੱਜ ਕੱਲ੍ਹ ਅੱਜ ਇੱਥੇ ਇਹ ਹੋ ਰਿਹਾ ਤੁਸੀਂ ਇੱਥੋਂ ਦਾ ਜੇ ਅਤੇ ਤੁਸੀਂ ਇੱਥੇ ਆਉਣਾ ਅਤੇ ਤੁਸੀਂ ਇੱਥੇ ਜਾ ਸਕਦੇ ਹੋ ਅੱਜ ਕੱਲ੍ਹ ਸਾਰਾ ਕੁਛ ਯੂਟਿਊਬ 'ਤੇ ਪਿਆ ਹੋਇਆ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਜ਼ਿੰਦਗੀ ਦੇ ਵਿੱਚ ਸਿਰਫ ਪੈਸਾ ਅਤੇ ਆਰਾਮ ਭਾਲ ਰਿਹਾ ਅੱਜ ਕੱਲ੍ਹ ਕਿਸੇ ਨੂੰ ਵੀ ਆਪਣੀ ਹੱਡ ਤੋੜ ਕੇ ਮਿਹਨਤ ਕਰਨ ਦੇ ਵਿੱਚ ਮਜ਼ਾ ਨਹੀਂ ਆਉਂਦਾ ਉਹ ਚਾਹੁੰਦਾ ਹੈ ਕਿ ਮੈਂ ਘਰ ਬੈਠਾ ਰਹਾਂ ਅਤੇ ਪੈਸੇ ਕਮਾਉਂਦਾ ਰਹਾਂ